ਖੇਡਾਂ ਜਿਹੜੀਆਂ ਵਾ ਖੇਡਾਂ ਬਹੁਤ ਹੀ ਜ਼ਿਆਦਾ ਪੋਜ਼ੀਟਿਵ ਪ੍ਰਭਾਵ ਪਾ ਸਕਦੀਆਂ ਵਾ ਉਹਦੇ 'ਚ ਬਹੁਤ ਜ਼ਿਆਦਾ ਸਮੁੱਚੀ ਗੁਣਵੱਤਾ ਦੇ ਉੱਤੇ ਉਹਨਾਂ ਦਾ ਕਾਰਨ ਕੀ ਆ ਵੀ ਜੇ ਤਾਂ ਜਦੋਂ ਬੱਚੇ ਖੇਡਦੇ ਆ ਜਾਂ ਕੋਈ ਵੀ ਖੇਡਦਾ ਵਾ ਉਹ ਪਹਿਲਾਂ ਇਕੱਠੇ ਬੈਠਦੇ ਆ ਇਕੱਠੇ ਹੁੰਦੇ ਆ ਇੱਕ ਗਰਾਊਂਡ ਦੇ ਵਿੱਚ ਜਿਹਦੇ ਵਿੱਚ ਵੱਖ ਵੱਖ ਧਰਮਾਂ ਦੇ ਵੱਖ ਵੱਖ ਜਾਤਾਂ ਦੇ ਲੋਕ ਇਕੱਠੇ ਹੋ ਜਾਂਦੇ ਆ ਅਤੇ ਇਕੱਠੇ ਖੇਡਦੇ ਆ ਇਕੱਠੇ ਖੇਡਣ ਨਾਲ਼ ਉਹਨਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਵਧਦਾ ਵਾ ਜ ਭਾਈਚਾਰਕ ਸਾਂਝ ਬਣਦੀ ਆ ਉਹਨਾਂ ਦੇ ਵਿੱਚ ਜਾਤ ਪਾਤ ਅਤੇ ਹੋਰ ਵੈ ਤਰ੍ਹਾਂ ਦੇ ਵੈਰ ਵਿਰੋਧ ਜਿਹੜੇ ਉਹ ਖ਼ਤਮ ਹੁੰਦੇ ਆ ਉਹਨਾਂ ਨੂੰ ਵੇਖ ਕੇ ਚੰਗੇ ਖਿਡਾਰੀਆਂ ਨੂੰ ਵੇਖ ਕੇ ਜਿਹੜੇ ਦੂਜੇ ਲੋਕ ਆਪਣੇ ਕਮਿਊਨਿਟੀ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵੀ ਧਿਆਨ ਬਣਦਾ ਕਿ ਅਸੀਂ ਬੱਚਿਆਂ ਨੂੰ ਆਪਣਿਆਂ ਨੂੰ ਜਿਹੜਾ ਉਹ ਖੇਡਾਂ ਵਾਲੇ ਬੰਨੇ ਜੋੜੀਏ ਖੇਡਾਂ ਦੇ ਨਾਲ਼ ਸਰੀਰ ਦੀ ਅਰੋਗਤਾ ਵੀ ਬਣਦੀ ਆ ਜਿਹੜੇ ਖਿਡਾਰੀ ਹੁੰਦੇ ਆ ਉਹ ਤੰਦਰੁਸਤ ਰਹਿੰਦੇ ਆ ਮਿਹਨਤ ਕਰਦੇ ਆ ਲੋਕ ਅਤੇ ਉਹਨਾਂ ਨੇ ਗਰਾਊਂਡਾਂ 'ਚ ਜਾਣਾ ਸ਼ੁਰੂ ਕਰ ਦਿੰਦੇ ਆ ਗਰਾਊਂਡਾਂ ਵਿੱਚ ਜਾਂ ਵੱਖੋ ਵੱਖਰੀਆਂ ਅਕੈਡਮੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਉਂਦੇ ਆ ਤਾਂ ਜੋ ਚੰਗੇ ਖੇਡ ਬਨ ਖਿਡਾਰੀ ਬਣ ਸਕਣ ਅਤੇ ਇਹੋ ਹੀ ਕਾਰਨ ਆ ਵੀ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਵੀ ਰਹਿੰਦੇ ਆ ਅਤੇ ਜੇ ਸਮੁੱਚੇ ਤੌਰ 'ਤੇ ਵੇਖਿਆ ਜਾਵੇ ਜਿਹੜੀਆਂ ਖੇਡਾਂ ਵਾ ਇਹ ਬਹੁਤ ਜ਼ਿਆਦਾ ਆਏ ਚੰਗਾ ਯੋਗਦਾਨ ਪਾਉਂਦੀਆਂ ਵਾਂ ਸਾਡੇ ਜਿਹੜੇ ਜਿਹੜੀ ਗੁਣਵੱਤਾ ਅਤੇ ਪੋਜ਼ੀਟਿਵਿਟੀ ਦੇ ਵਿੱਚ